ਖੁੱਲ੍ਹੇ ਪਾਣੀ ਵਿੱਚ ਤੈਰਾਕੀ ਕਰਦੇ ਸਮੇਂ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਹੈ ਜਿਸ ਤਰ੍ਹਾਂ ਕਿ ਪਾਣੀ ਵਿੱਚ ਐਲਗੀ ਹੁੰਦੀ ਹੈ ਪੱਥਰ ਦੀਆਂ ਚਟਾਨਾਂ ਹੁੰਦੀਆਂ ਪਾਣੀ ਦਾ ਤੇਜ ਵਹਾਅ ਹੁੰਦਾ ਇਹ ਸਾਰੀਆਂ ਮੁੱਖ ਰੁਕਾਵਟਾਂ ਹੈ ਜੋ ਖੁੱਲ੍ਹੇ ਪਾਣੀ ਵਿੱਚ ਆਉਂਦੀਆਂ ਪਾਣੀ ਦੀ ਡੁੰਘਾਈ ਬਾਰੇ ਜਾਣਕਾਰੀ ਸਾਨੂੰ ਨਹੀਂ ਹੁੰਦੀ ਇਸ ਦੇ ਲਈ ਜਿਹੜੇ ਸੁਰੱਖਿਅਤ ਰਹਿਣ ਦੇ ਵੱਖ ਵੱਖ ਤਰੀਕੇ ਨੇ ਸਭ ਤੋਂ ਪਹਿਲਾਂ ਤਰੀਕਾ ਕਿ ਜਦੋਂ ਵੀ ਅਸੀਂ ਕਿਸੇ ਖੁੱਲ੍ਹੇ ਪਾਣੀ ਵਿੱਚ ਤੈਰਾਕੀ ਕਰਦੇ ਹਾਂ ਤਾਂ ਉੱਥੇ ਸਾਡੇ ਨਾਲ ਸਾਡਾ ਅਮਲਾ ਫੈਲਾ ਉਹ ਜ਼ਰੂਰ ਹੋਣਾ ਚਾਹੀਦਾ ਤਾਂ ਜੋ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਬਾਹਰ ਖੜ੍ਹਾ ਇਨਸਾਨ ਉਸ ਦੀ ਮਦਦ ਕਰ ਸਕੇ ਇਸ ਦੇ ਨਾਲ ਹੀ ਸੁਰੱਖਿਆ ਬਿਲਟਾਂ ਇਹ ਉਸ ਤਰ੍ਹਾਂ ਉਸ ਜਗ੍ਹਾ 'ਤੇ ਲਾਜ਼ਮੀ ਹੋਣੀਆਂ ਚਾਹੀਦੀਆਂ ਤਾਂ ਜੋ ਕਿਸੇ ਵੀ ਔਖੇ ਸਮੇਂ ਵਿੱਚ ਉਹ ਮਦਦ ਕੀਤੀ ਜਾ ਸਕੇ ਆਕਸੀਜਨ ਸਲਿੰਡਰ ਕਿਉਂਕਿ ਤੈਰਾਕੀ ਪਾਣੀ ਦੀ ਗੇਮ ਹੈ ਤਾਂ ਆਕਸੀਜਨ ਸਲਿੰਡਰ ਦੀ ਜਿਹੜੀ ਮਹੱਤਤਾ ਸਭ ਤੋਂ ਵੱਧ ਹੁੰਦੀ ਹੈ ਜੇਕਰ ਪਾਣੀ ਮੂੰਹ ਵਿੱਚ ਚਲਾ ਜਾਂਦਾ ਹੈ ਤਾਂ ਉਸ ਨੂੰ ਬਾਹਰ ਕੱਢਣ ਦੇ ਉਪਾਅ ਇਹ ਵੀ ਜੋ ਅਮਲਾ ਉਸ ਨੂੰ ਹੋਣੇ ਚਾਹੀਦੇ ਨੇ ਤਾਂ ਜੋ ਕਿਸੇ ਵੀ ਸਿਚੁਏਸ਼ਨ ਵਿੱਚ ਤੈਰਾਕੀ ਵਾਲੇ ਇਨਸਾਨ ਦੀ ਮਦਦ ਕੀਤੀ ਜਾ ਸਕੇ ਇਸ ਦੇ ਨਾਲ ਹੀ ਤੈਰਾਕ ਨੂੰ ਵੀ ਦੇਖਣਾ ਚਾਹੀਦਾ ਕਿ ਉਹ ਜਿਹੜੀ ਪਾਣੀ ਵਾਲੀ ਜਗ੍ਹਾ ਉਹ ਸਾਫ ਸਫਾਈ ਹੈ ਉੱਥੇ ਜਗ੍ਹਾ 'ਤੇ ਇਸ ਦੇ ਨਾਲ ਹੀ ਉਸ ਜਗ੍ਹਾ ਵਿੱਚ ਕੋਈ ਜਾਨਵਰ ਤਾ ਨਹੀਂ ਜੋ ਸਾਨੂੰ ਨੁਕਸਾਨ ਪਹੁੰਚਾ ਸਕੇ